ਅਸੀਂ ਬਾਗਬਾਨੀ ਜੀ ਵਿਹੜੇ ਵਿੱਚ ਕਰਕੇ ਜ਼ਿਆਦਾ ਖੁਸ਼ ਹਾਂ ਕਿਉਂਕਿ ਵਿਹੜੇ ਵਿੱਚ ਇੱਕ ਤਾਂ ਖੁੱਲ੍ਹੀ ਜਗ੍ਹਾ ਹੁੰਦੀ ਹੈ ਅਤੇ ਅਸੀਂ ਸ਼ੁਰੂ ਤੋਂ ਹੀ ਵਿਹੜੇ ਵਿੱਚ ਬਾਗਬਾਨੀ ਕਰਦੇ ਹਾਂ ਅਤੇ ਕਿਉਂਕਿ ਛੱਤ ਉੱਪਰ ਸਾਨੂੰ ਦਿੱਕਤ ਆਉਂਦੀ ਹੈ ਛੱਤ ਉੱਪਰ ਅਸੀਂ ਬਾਗਬਾਨੀ ਮਤਲਬ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਦੁਬਾਰਾ ਦੁਬਾਰਾ ਛੱਤ ਉੱਪਰ ਚੜ੍ਹਨਾ ਪੈਂਦਾ ਹੈ ਪਾਣੀ ਪਾਉਣ ਲਈ ਕਿਉਂਕਿ ਵਿਹੜੇ ਵਿੱਚ ਸਾਡੀ ਸਾਰੀ ਸੁਵਿਧਾ ਹੁੰਦੀ ਹੈ ਜਿਵੇਂ ਘਰ ਵਿੱਚ ਜਾਂ ਵਿਹੜੇ ਸਾਡੇ ਮੋਟਰਾਂ ਵਗੈਰਾ ਆਮ ਜਾਂ ਪਾਣੀ ਦੀ ਕੋਈ ਦਿੱਕਤ ਨਹੀਂ ਹੁੰਦੀ ਅਤੇ ਮੋਟਰਾਂ ਦਾ ਪਾਣੀ ਆਉਂਦਾ ਹੈ ਸਾਨੂੰ ਵਿਹੜੇ ਵਿੱਚ ਇਸ ਕਰਕੇ ਅਸੀਂ ਛੱਤ 'ਤੇ ਤਾਂ ਸੁਬਾਹ ਸ਼ਾਮ ਹੀ ਚੜ੍ਹਦੇ ਹਾਂ ਵਿਹੜੇ ਵਿੱਚ ਆਮ ਸਾਡੀ ਨਿਗਾਹ ਸਾਰਾ ਦਿਨ ਅਸੀਂ ਤੁਰਦੇ ਫਿਰਦੇ ਰਹਿੰਦੇ ਹਾਂ ਸਾਨੂੰ ਪਤਾ ਲੱਗਦਾ ਰਹਿੰਦਾ ਹੈ ਕਿ ਆਹ ਪੌਦਾ ਕਿੱਦਾਂ ਦਾ ਅਤੇ ਸੜ ਗਿਆ ਜਾਂ ਮੱਚ ਗਿਆ ਅਤੇ ਕਿਉਂਕਿ ਸਾਨੂੰ ਵੀ ਵਿਹੜੇ ਵਿੱਚ ਖੇਤੀ ਕਰਨੀ ਬਹੁਤ ਵਧੀਆ ਲੱਗਦੀ ਹੈ ਜੋ ਕਿ ਬਾਗਵਾਨੀ ਅਸੀਂ ਵਿਹੜੇ ਵਿੱਚ ਖੁੱਲੀ ਜਗ੍ਹਾ ਹੈ ਅਤੇ ਸਾਨੂੰ ਵੈਸੇ ਵੀ ਆਸਾਨ ਹੈ ਕਿਉਂਕਿ ਸਾਡਾ ਵਿਹੜੇ ਵਿੱਚ ਸਾਡਾ ਧਿਆਨ ਰਹਿੰਦਾ ਹੈ ਅਤੇ ਛੱਤ ਉੱਪਰ ਕਿਉਂਕਿ ਗਰਮੀ ਵਗੈਰਾ ਜ਼ਿਆਦਾ ਹੁੰਦੀ ਹੈ ਅਤੇ ਇਸ ਲਈ ਅਸੀਂ ਵਿਹੜੇ ਵਿੱਚ ਜ਼ਿਆਦਾ ਕਰਕੇ ਖੁਸ਼ ਹਾਂ ਕਿਉਂਕਿ ਵਿਹੜੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਗੀ ਖੁੱਲ੍ਹੀ ਜਗ੍ਹਾ ਹੁੰਦੀ ਹੈ ਪਾਣੀ ਦੀ ਸੁਵਿਧਾ ਵੀ ਹੁੰਦੀ ਹੈ ਉਂ ਵੀ ਅਸੀਂ ਵਿਹੜੇ ਵਿੱਚ ਜਦੋਂ ਫ੍ਰੀ ਹੁੰਦੇ ਹਾਂ ਤਾਂ ਉਦੋਂ ਅਸੀਂ ਸਾਰਾ ਸੰਭਾਲ ਸਕਦੇ ਹਾਂ ਦੇਖਭਾਲ ਕਰ ਸਕਦੇ ਹਾਂ ਧੰਨਵਾਦ ਜੀ